ਪਹਿਲੇ ਵਾਲੇ ਟਾਈਮ ਵਿੱਚ ਅਸੀਂ ਰੱਸਿਆਂ ਨਾਲ ਖੂਹ ਚੋਂ ਪਾਣੀ ਕਰਦੇ ਸੀ ਪਰ ਹੁਣ ਤਾਂ ਸਾਇੰਸ ਨੇ ਬਹੁਤ ਤਰੱਕੀ ਕਰ ਲਿਤੀ ਹ ਉਹਨਾਂ ਨੇ ਇਲੈਕਟਰਿਕ ਮੋਟਰ ਦਾ ਪ੍ਰਯੋਗ ਕਰਨ ਲਈ ਕਿਹਾ ਹੈ ਹੁਣ ਅੱਜ ਕੱਲ ਲੋਗ ਬਹੁਤ ਆਸਾਨੀ ਨਾਲ ਇਲੈਕਟਰਿਕ ਮੋਟਰ ਦਾ ਪ੍ਰਯੋਗ ਕਰਦੇ ਹਨ ਉਹਦੇ ਨਾਲ ਆਸਾਨੀ ਨਾਲ ਪਾਣੀ ਕੱਢ ਲੈਂਦੇ ਹਨ ਜੋ ਕਿ ਉਹਨਾਂ ਦੇ ਖੇਤਾਂ ਵਿੱਚ ਵੀ ਜਾਂਦਾ ਹੈ ਪੀਣ ਲਈ ਨਾਹਣ ਲਈ ਹਰ ਜਗਹਾ ਕੰਮ ਆਉਂਦਾ ਇਲੈਕਟਰਿਕ ਮੋਟਰ ਦੀ ਪ੍ਰਯੋਗ ਨਾਲ ਬਜ਼ੁਰਗ ਵੀ ਖੂਹ ਚੋਂ ਪਾਣੀ ਕੱਢ ਲੈਂਦੇ ਹਨ ਬਹੁਤ ਆਸਾਨੀ ਨਾਲ ਜੋ ਕਿ ਪਹਿਲੇ ਟਾਈਮ 'ਚ ਇਹ ਸਭ